ਹਾਂਜੀ ਹਾਂਜੀ ਮੈਂ ਹੁਸ਼ਿਆਰਪੁਰ ਤੋਂ ਗੱਲ ਕਰ ਰਹੀ ਹਾਂ ਹੁਸ਼ਿਆਰਪੁਰ ਦਾ ਵੈਦਰ ਮਤਲਬ ਇੱਕ ਸਟੇਬਲ ਵੈਦਰ ਨਹੀਂ ਆ ਇੱਥੇ ਮਤਲਬ ਕਿ ਕਦੀ ਤੁਸੀਂ ਦੇਖੋਗੇ ਕਿ ਮਤਲਬ ਕਿ ਬਾਰਿਸ਼ ਬਹੁਤ ਵਧ ਮਲ ਕਿ ਪੈਂਦੀ ਹੈ ਤਾਂ ਬਹੁਤ ਵਧੀਆ ਪੈਂਦੀ ਆ ਠੀਕ ਹੈ ਸੀਜਨਲ ਠੀਕ ਹੈ ਉਸ ਤੋਂ ਇਲਾਵਾ ਮਤਲਬ ਕਿ ਇੱਥੇ ਗਰੀਨਰੀ ਮਤਲਬ ਕਿ ਸਾਡੇ ਹਰਿਆਲੀ ਬਹੁਤ ਜ਼ਿਆਦਾ ਆ ਅਤੇ ਕਾਫੀ ਵਧੀਆ ਇਨਵਾਇਰਮੈਂਟ ਆ ਮਤਲਬ ਕਿ ਹਵਾ ਵੀ ਪਿਓਰ ਆ ਜਦੋਂ ਫੈਸਟੀਵਲ ਵਗੈਰਾ ਆਉਂਦੇ ਆ ਉਦੋਂ ਥੋੜ੍ਹਾ ਜਿਹਾ ਪਲਿਊਟਿਡ ਹੋ ਜਾਂਦਾ ਬਟ ਬਾਕੀ ਮਤਲਬ ਕਿ ਬਾਕੀ ਵੀ ਕਹਾਂ ਤਾਂ ਸਹੀ ਦੱਸਾਂ ਤਾਂ ਮਤਲਬ ਕਿ ਬਹੁਤ ਵਧੀਆ ਰਹਿੰਦਾ ਵੈਦਰ ਇੱਥੇ ਹੁਣ ਜਿੱਦਾਂ ਕਿ ਹੁਣ ਚੱਲ ਰਿਹਾ ਇਸ ਟਾਈਮ 'ਤੇ ਜਿੱਦਾਂ ਹੁਣ ਸੀਜ਼ਨ ਜਿਹੜਾ ਚੱਲ ਰਿਹਾ ਹੁਣ ਥੋੜ੍ਹੀ ਕੋਲਡ ਮਤਲਬ ਕਿ ਏਅਰ ਚੱਲ ਰਹੀ ਹੈ ਥੋੜ੍ਹੀ ਥੋੜ੍ਹੀ ਲੇਕਿਨ ਮਤਲਬ ਕਿ ਲਾਈਕ ਸੰਨਲਾਈਟ ਵੀ ਆ ਰਹੀ ਹੈਗੀ ਤੁਹਾਨੂੰ ਮਤਲਬ ਕਿ ਗਰਮੀ ਥੋੜ੍ਹੀ ਫੀਲ ਹੋਏਗੀ ਮਤਲਬ ਕਿ ਥੋੜ੍ਹਾ ਮਿਕਸ ਜਿਹਾ ਵੈਦਰ ਚੱਲਦਾ ਇਸ ਟਾਈਮ 'ਤੇ ਅਤੇ ਇਸ ਕਰਕੇ ਤੁਹਾਨੂੰ ਮਤਲਬ ਕਿ ਜੇ ਤੁਸੀਂ ਕਿਆ ਲਾਉਂਦੇ ਹੋ ਕਿ ਮੈਂ ਕਿਹੜੇ ਕੱਪੜੇ ਲੈ ਕੇ ਆਵਾਂ ਤਾਂ ਉਸ ਲਈ ਮੈਂ ਤੁਹਾਨੂੰ ਇਹੀ ਸਲਾਹ ਦਊਂਗੀ ਕਿ ਤੁਸੀਂ ਮਤਲਬ ਕਿ ਅਜੇ ਇਸ ਤਰ੍ਹਾਂ ਦੇ ਮਤਲਬ ਕਿ ਕੱਪੜੇ ਲੈ ਕੇ ਆਓ ਕਿ ਜਿਹਦੇ ਨਾਲ ਨਾ ਤਾਂ ਜ਼ਿਆਦਾ ਗਰਮੀ ਲੱਗੇ ਅਤੇ ਨਾ ਤਾਂ ਜ਼ਿਆਦਾ ਠੰਡ ਲੱਗੇ ਥੋੜ੍ਹੇ ਮੀਡੀਅਮ ਟਾਈਪ ਕਿਉਂਕਿ ਮੋਰਨਿੰ ਮੋਰਨਿੰਗ ਵੇਲੇ ਜ਼ਿਆਦਾ ਠੰਡ ਹੋ ਜਾਂਦੀ ਹੈ ਅਤੇ ਈਵਨਿੰਗ ਵੇਲੇ ਠੰਡ ਹੋ ਜਾਂਦੀ ਹੈ ਲੇਕਿਨ ਜਿਹੜਾ ਦੁਪਹਿਰ ਦਾ ਟਾਈਮ ਹੈ ਉਸ ਟਾਈਮ 'ਤੇ ਮਤਲਬ ਕਿ ਗਰਮੀ ਰਹਿੰਦੀ ਹੈ ਅਤੇ ਜਿਹੜਾ ਹੁਣ ਕਰੰਟਲੀ ਵੈਦਰ ਚੱਲ ਰਿਹਾ ਹੈ ਵੈਸੇ ਤਾਂ ਜਦੋਂ ਮਤਲਬ ਕਿ ਆਹ ਹੁਣ ਜਿੱਦਾਂ ਕਿ ਕੋਈ ਵੀ ਅ ਆਉਂਦਾ ਆਪਣਾ ਸਤੰਬਰ ਅਕਟੂਬਰ ਜੁਲਾਈ ਅਗਸਤ ਅਤੇ ਉਸ ਟਾਈਮ 'ਤੇ ਜੂਨ ਦੇ ਵਿੱਚ ਗਰਮੀ ਹੁੰਦੀ ਆ ਬਟ ਜੁਲਾਈ ਅਗਸਤ ਦੇ ਵਿੱਚ ਕੀ ਹੁੰਦਾ ਆਪਣਾ ਰੇਨਿੰਗ ਸੀਜ਼ਨ ਸ਼ੁਰੂ ਹੋ ਜਾਂਦਾ ਅਤੇ ਉਦੋਂ ਰੇਨਿੰਗ ਵੀ ਮਤਲਬ ਕਿ ਕਾਫੀ ਦੇਰ ਤੱਕ ਚੱਲਦੀ ਹੈ ਤਿੰਨ ਚਾਰ ਮਤਲਬ ਕਿ ਦਿਨ ਲਗਾਤਾਰ ਚਲਦੀ ਹੈ ਅਤੇ ਕਾਫੀ ਵਧੀਆ ਰਹਿੰਦੀ ਆ ਵੀ ਉਹ ਆਉਂਦੀ ਆ ਬਾਰਿਸ਼ ਤਾਂ ਬਹੁਤ ਵਧੀਆ ਆਉਂਦੀ ਹੈ ਅਤੇ ਠੰਡ ਵੀ ਵਧੀਆ ਰਹਿੰਦੀ ਇੱਥੇ ਵਧੀਆ ਮਤਲਬ ਕਿ ਹਿਮਾਚਲ ਸਾਡੇ ਨਾਲ ਲੱਗਦਾ ਬਿਲਕੁਲ ਹੁਸ਼ਿਆਰਪੁਰ ਦੇ ਨਾਲ ਅਤੇ ਇਸ ਕਰਕੇ ਥੋੜ੍ਹਾ ਕੋਲਡ ਵੈਦਰ ਇੱਥੇ ਜ਼ਿਆਦਾ ਰਹਿੰਦਾ ਹੈ ਅਤੇ ਵਧੀਆ ਪਿਓਰੀਫਾਈਡ ਏਅਰ ਵੀ ਹੁੰਦੀ ਆ ਅਤੇ ਹਾਂਜੀ ਲੇਕਿਨ ਕਰੰਟਲੀ ਵੈਦਰ ਦੇ ਕੋ

ਏਅਰ ਕੰਡੀਸ਼ਨ ਦੀ ਮਤਲਬ ਕਿ ਜ਼ਰੂਰਤ ਪੈਂਦੀ ਆ ਕਿਉਂਕਿ ਗਰਮੀ ਇੱਥੇ ਹੈਗੀ ਆ ਕਿਉਂਕਿ ਜਦ ਗਰਮੀ ਵੈਸੇ ਤਾਂ ਮਤਲਬ ਕਿ ਜਦ ਸਟਾਰਟਿੰਗ ਹੁੰਦੀ ਹੈ ਤਾਂ ਇੰਨੀ ਗਰਮੀ ਨਹੀਂ ਹੁੰਦੀ ਪਰ ਜਦੋਂ ਜੂਨ ਦਾ ਜਿਹੜਾ ਸੀਜ਼ਨ ਹੁੰਦਾ ਜੁਲਾਈ ਦਾ ਥੋੜ੍ਹਾ ਥ੍ਰੀ ਮੰਨਥ ਜਿਹੜੇ ਆਪਣੇ ਹੁੰਦੇ ਆ ਜੂਨ ਜੁਲਾਈ ਅਤੇ ਆਪਣਾ ਥੋੜ੍ਹਾ ਅਗਸਤ ਠੀਕ ਠੀਕ ਮੌਸਮ ਹੋ ਜਾਂਦਾ ਬਟ ਜਿਹੜੇ ਆਹ ਦੋ ਤਿੰਨ ਮੰਥ ਆ ਉਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਆ ਅਤੇ ਵੈਸੇ ਤਾਂ ਤੁਸੀਂ ਮਤਲਬ ਕਿ ਜੇ ਸਿੰਪਲ ਤੁਸੀਂ ਕੂਲਰ ਵੀ ਯੂਜ ਕਰ ਸਕੋ ਤਾਂ ਉਹਦੇ ਨਾਲ ਵੀ ਕਾਫੀ ਠੰਡਾ ਹੋ ਜਾਂਦਾ ਇੱਦਾਂ ਦੀ ਕੋਈ ਇਹ ਨਹੀਂ ਹੈਗਾ ਸਿਰਫ ਏ ਸੀ ਹੀ ਲਗਾਉਣਾ ਏਅਰ ਕੰਡੀਸ਼ਨ ਹੀ ਯੂਜ ਕਰਨਾ ਬਟ ਤੁਸੀਂ ਮਤਲਬ ਕਿ ਐਜ ਆ ਸੁਜੈਸ਼ਨ ਅਗਰ ਦਿੱਤਾ ਜਾਵੇ ਤਾਂ ਮਤਲਬ ਕਿ ਤੁਸੀਂ ਕੂਲਰ ਯੂਜ ਕਰ ਸਕਦੇ ਹੋ ਕਿਉਂਕਿ ਇੱਥੇ ਮੋਰਨਿੰਗ ਅਤੇ ਈਵਨਿੰਗ ਟਾਈਮ ਥੋੜ੍ਹਾ ਵੈਦਰ ਠੰਡਾ ਰਹਿੰਦਾ ਹਿਮਾਚਲ ਕਰਕੇ ਇੰਨੀ ਜ਼ਿਆਦਾ ਵੀ ਗਰਮੀ ਨਹੀਂ ਹੁੰਦੀ ਸਿਰਫ ਰਾਤ ਦਾ ਟਾਈਮ ਥੋੜ੍ਹੀ ਦਿਨੇ ਥੋੜ੍ਹੀ ਗਰਮੀ ਰਹਿੰਦੀ ਆ ਮੋਰਨਿੰਗ ਥੋੜ੍ਹਾ ਠੰਡਾ ਹੋ ਜਾਂਦਾ ਨਹੀਂ ਨਹੀਂ ਇੱਥੇ ਫਲੱਡਸ ਵੈਸੇ ਅੱਜ ਤੱਕ ਤਾਂ ਐਦਾਂ ਦਾ ਕੋਈ ਸੀਜ਼ਨ ਨਹੀਂ ਹੋਇਆ ਬਟ ਆਉਂਦੇ ਆ ਬਟ ਉਹ ਥੋੜ੍ਹੇ ਮਤਲਬ ਕਿ ਆਪਣੇ ਜਿੱਦਾਂ ਆਪਣੇ ਪੰਗੀਚੋ ਵਾਲੀ ਸਾਈਡ ਉੱਧਰਲੀ ਸਾਈਡ ਥੋੜ੍ਹਾ ਬਹੁਤ ਹੋ ਜਾਂਦਾ ਕਿਉਂਕਿ ਥੋੜ੍ਹਾ ਏਰੀਆ ਵੀ ਥੋੜ੍ਹਾ ਉਹੋ ਜਿਹਾ ਥੋੜ੍ਹਾ ਲੇਕਿਨ ਆਪਣੇ ਫਲੱਡ ਇੰਨਾ ਜ਼ਿਆਦਾ ਰਿਸਕ ਨਹੀਂ ਹੈਗਾ ਕਿ ਪੂਰਾ ਫਲੱਡ ਹੀ ਆ ਜਾਵੇ ਇਹੋ ਜਿਹਾ ਕੋਈ ਹੈ ਨਹੀਂ ਕਿਉਂਕਿ ਆਪਣੇ ਕਾਫੀ ਮਤਲਬ ਕਿ ਐਦਾਂ ਕਿ ਟਰੀਸ ਵਗੈਰਾ ਪਲਾਂਟਿੰਗ ਵਗੈਰਾ ਹੈਗੀ ਹੈ ਅਤੇ ਉਹਨੂੰ ਕੰਟਰੋਲ ਕਰਨ ਲਈ ਬਿਲਡਿੰਗ ਕਾਫੀ ਹੈਗੀਆਂ ਥੋੜ੍ਹਾ ਆਪਣਾ ਏਰੀਆ ਜਿਹੜਾ ਮਤਲਬ ਕਿ ਇੱਥੇ ਦਾ ਜਿਹੜਾ ਹੈਗਾ ਨਾ ਇੱਥੇ ਕਾਫੀ ਕਲੋਨੀ ਟਾਈਪ ਬਣਿਆ ਹੋਇਆ ਅਤੇ ਉਹਨੂੰ ਮਤਲਬ ਕਿ ਕੰਟਰੋਲ ਕਰਨ ਲਈ ਹੈ ਅਤੇ ਜੇ ਮਤਲਬ ਕਿ ਉਹਦੇ ਤੋਂ ਪ੍ਰੋਟੈਕਟ ਕਰਨ ਲਈ ਕੀਤੀ ਜਾਵੇ ਕਿ ਕੋਈ ਆ ਰਿਹਾ ਮਤਲਬ ਕਿ ਫਲੱਡ ਆ ਰਿਹਾ ਜਾਂ ਕੁਛ ਸਾਡੇ ਸਭ ਤੋਂ ਹਾਈਐਸਟ ਬਿਲਡਿੰਗ ਵੀ ਵਗੈਰਾ ਸਾਡੇ ਲਈ ਮਤਲਬ ਕਿ ਸੇਫਏਸਟ ਹੈਗੀ ਇੱਥੇ ਕੋਲ ਹੀ ਹੋਰ ਕੋਈ ਕੋਈ ਓਕੇ ਸਰ